ਪੰਦਰਾਂ ਅਗਸਤ ਉੱਨੀ ਸੌ ਸੰਤਾਲ਼ੀ ਵੀਹ ਜੂਨ ਉੱਨੀ ਸੌ ਪੰਜਾਹ ਦੋ ਅਕਤੂਬਰ ਉੱਨੀ ਸੌ ਇਕਾਸੀ ਇੱਕ ਜੂਨ ਉੱਨੀ ਸੌ ਤ੍ਰਿਆਸੀ ਇਕੱਤੀ ਅਕਤੂਬਰ ਦੋ ਹਜ਼ਾਰ ਦਸ